ਇਹ ਸਵਾਲ ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਬੈਂਕਿੰਗ ਅਤੇ ਬੀਮਾ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਬਣ ਗਏ ਹਨ ਅੱਜ ਅਸੀਂ ਆਪਣੇ ਪੈਸੇ ਨੂੰ ਬਚਾਉਣ ਅਤੇ ਨਿਵੇਸ਼ ਕਰਨ ਲਈ ਬਹੁਤ ਸਾਰੇ ਨਵੇਂ ਤਰੀਕਿਆਂ ਦੀ ਵਰਤੋਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਕ੍ਰੈਡਿਟ ਕਾਰਡ ਕਰੈਡਿਟ ਕਾਰਡ ਨੇ ਸਾਡੇ ਖਰਚ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਅਸੀਂ ਹੁਣ ਨਕਦ ਦੀ ਬਜਾਏ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਖਰੀਦਦਾਰੀ ਕਰ ਸਕਦੇ ਹਾਂ ਇਸ ਨਾਲ ਸਾਨੂੰ ਖਰਚਿਆਂ ਨੂੰ ਟਰੈਕ ਕਰਨਾ ਅਤੇ ਬਜਟ ਬਣਾਉਣਾ ਆਸਾਨ ਹੋ ਜਾਂਦਾ ਹੈ ਦੂਜਾ ਸਟੋਕ ਮਾਰਕੀਟ ਸਟੋਕ ਮਾਰਕੀਟ ਨੇ ਸਾਨੂੰ ਨਿਵੇਸ਼ ਕਰਨ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਹਨ ਅਸੀਂ ਹੁਣ ਘਰ ਬੈਠੇ ਹੀ ਸਟੋਕਾਂ ਵਿੱਚ ਨਿਵੇਸ਼ ਕਰ ਸਕਦੇ ਹਾਂ ਇਸ ਨਾਲ ਸਾਨੂੰ ਆਪਣੇ ਪੈਸੇ ਨੂੰ ਵਧਾਉਣ ਦਾ ਮੌਕਾ ਮਿਲਦਾ ਹੈ ਤੀਜਾ ਆਨਲਾਈਨ ਮੋਬਾਈਲ ਬੈਂਕਿੰਗ ਟੂਲ ਆਨਲਾਈਨ ਮੋਬਾਈਲ ਬੈਂਕਿੰਗ ਟੂਲ ਨੇ ਸਾਡੇ ਲਈ ਆਪਣੇ ਖਰਚਿਆਂ ਨੂੰ ਟਰੈਕਰ ਨਾਲ ਅਤੇ ਬਜਟ ਬਣਾਉਣਾ ਆਸਾਨ ਬਣਾ ਦਿੱਤਾ ਹੈ ਅਸੀਂ ਹੁਣ ਆਪਣੇ ਮੋਬਾਇਲ ਫੋਨ 'ਤੇ ਹੀ ਆਪਣੇ ਖਰਚਿਆਂ ਨੂੰ ਟਰੈਕ ਕਰ ਸਕਦੇ ਹਾਂ ਅਤੇ ਬਜਟ ਵੀ ਬਣਾ ਸਕਦੇ ਹਾਂ ਇਸ ਤੋਂ ਇਲਾਵਾ ਬੀਮਾ ਵੀ ਸਾਡੇ ਪੈਸਿਆਂ ਨੂੰ ਬਚਾਉਣ ਵਿੱਚ ਮਦਦ ਕਰਦਾ ਹੈ ਬੀਮਾ ਸਾਨੂੰ ਕਈ ਖਰਚਿਆਂ ਤੋਂ ਬਤਾ ਬਚਾਉਂਦਾ ਹੈ ਜਿਵੇਂ ਕਿ ਬਿਮਾਰੀ ਜਾਂ ਦੁਰਘਟਨਾ ਮੈਨੂੰ ਲੱਗਦਾ ਹੈ ਕਿ ਬੈਂਕਿੰਗ ਅਤੇ ਬੀਮਾ ਸਾਡੇ ਪੈਸੇ ਨੂੰ ਬਚਾਉਣ ਲਈ ਨਿਵੇਸ਼ ਕਰਨ ਦੇ ਤਰੀਕੇ ਨੂੰ ਬਹੁਤ ਬਦਲ ਰਹੇ ਹਨ ਇਹ ਸਾਨੂੰ ਆਪਣੇ ਵਿੱਥ ਨੂੰ ਬਿਹਤਰ ਢੰਗ ਨਾਲ ਪ੍ਰਬੰਧ ਕਰਨ ਵਿੱਚ ਵੀ ਮਦਦ ਕਰ ਰਹੇ ਹਨ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਬੈਂਕਿੰਗ ਅਤੇ ਬੀਮਾ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ